ਜਦੋਂ ਤੁਹਾਨੂੰ ਥੋੜ੍ਹੇ ਦਿਨਾਂ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਤੁਸੀਂ ਪੌਦਿਆਂ ਦਾ ਕੀ ਕਰਦੇ ਹੋ ਇਹਨਾਂ ਦੀ ਦੇਖਭਾਲ ਕੌਣ ਕਰਦਾ ਹਾਂਜੀ ਸਰ ਜਿਵੇਂ ਕਿ ਅਸੀਂ ਥੋੜ੍ਹੇ ਦਿਨ ਲਈ ਬਾਹਰ ਜਾਂਦੇ ਹਾਂ ਜਿਵੇਂ ਕਿ ਮੈਂ ਕਾਲਜ ਵਿੱਚ ਮਾਲੀ ਦਾ ਹੀ ਕੰਮ ਕਰਦਾ ਸਰ ਪਹਿਲਾਂ ਤਾਂ ਆਪਣੇ ਵੱਲੋਂ ਜਿ ਜਿੰਨੇ ਕੁ ਜੋ ਹੁੰਦਾ ਤਸੱਲੀਬਖਸ਼ ਕੰਮ ਕਰਕੇ ਸਰ ਉਸ ਤੋਂ ਬਾਅਦ ਅਗਲੇ ਜਿਹੜਾ ਦੂਜਾ ਬੰਦਾ ਹੁੰਦਾ ਉਹਦੀ ਅਜੈਸਟਮੈਂਟ ਕਰਾ ਕੇ ਉਹਦੀ ਡਿਊਟੀ ਲਗਾਈ ਜਾਂਦੀ ਹੈ ਜੀ ਮੇਰੇ ਤੋਂ ਬਾਅਦ ਉਹਨਾਂ ਦੀ ਦੂਜਿਆਂ ਬੰਦਾ

ਜਿਹਦੀ ਅਜੈਸਟਮੈਂਟ ਹੋਈ ਹੁੰਦੀ ਹੈ ਉਹ ਉਹਨਾਂ ਦੀ ਦੇਖਭਾਲ ਸਰ ਕਰਦਾ ਜਿਹਦੇ ਕਾਰਨ ਕਿ ਬੂਟਿਆਂ ਨੂੰ ਸਹੀ ਤਰੀਕੇ ਨਾਲ ਸਾਂਭਿਆ ਜਾ ਸਕੇ ਜਾਂ ਧੁੱਪ ਤੋਂ ਛਾਂ ਛਾਂ 'ਚ ਧੁੱਪ 'ਚੋਂ ਛਾਂ ਜਾਂ ਛਾਂ 'ਚ ਧੁੱਪਾਂ ਵਿੱਚ ਉਹ ਹੀ ਬੰਦਾ ਰੱਖੂਗਾ ਜਿਹਦੀ ਕਿ ਅਜੈਸਟਮੈਂਟ ਹੋਈ ਹੁੰਦੀ ਹੈ